ਹਾਂਜੀ ਸ਼੍ਰੀਮਾਨ ਜੀ ਟਾਟਾ ਟੈਲੀਕੋਮ ਮੋਹਾਲੀ ਤੋਂ ਗੱਲ ਕਰ ਰਹੇ ਹੋ ਮੈਂ ਗੁਰਸੇਵਕ ਸਿੰਘ ਗੱਲ ਕਰ ਰਿਹਾ ਜੀ ਮੋਹਾਲੀ ਤੋਂ ਜੀ ਸ਼੍ਰੀਮਾਨ ਜੀ ਮੈਂ ਨਾ ਤੁਹਾਡੇ ਕੋਲ਼ੋ ਪਿਛਲੇ ਮਹੀਨੇ ਇੱਕ ਫ਼ੋਨ ਖਰੀਦਿਆ ਸੀ ਅਤੇ ਇਹ ਫ਼ੋਨ ਮੈਂ ਜਿਸ ਦਿਨ ਔਡਰ ਕੀਤਾ ਸੀ ਮੈਨੂੰ ਔਡਰ ਕਰਨ ਤੋਂ ਤਕਰੀਬਨ ਦੋ ਜਾਂ ਤਿੰਨ ਦਿਨ ਤੋਂ ਬਾਅਦ ਮੈਨੂੰ ਇਹ ਇਹ ਫ਼ੋਨ ਪ੍ਰਾਪਤ ਹੋਇਆ ਫ਼ੋਨ ਪ੍ਰਾਪਤ ਹੋਣ ਤੋਂ ਬਾਅਦ ਮੈਂ ਇਹ ਫ਼ੋਨ ਹੁਣ ਤੱਕ ਯੂਜ ਕਰ ਰਿਹਾ ਇਹ ਫ਼ੋਨ ਦੀ ਜਿਹੜੀ ਕੁਆਲੀਟੀ ਹੈ ਬਹੁਤ ਵਧੀਆ ਇਹਦੀ ਜਿਹੜੀ ਅਵਾਜ਼ ਦੀ ਕੁਆਲਟੀ ਹੈ ਉਹ ਵੀ ਬਹੁਤ ਅੱਛੀ ਹੈ ਔਰ ਇਹਦੀ ਜਿਹੜੀ ਕੈਮਰੇ ਦੀ ਕੁਆਲਟੀ ਹੈ ਉਹ ਵੀ ਬਹੁਤ ਅੱਛੀ ਹੈ ਸਭ ਤੋਂ ਵੱਡੀ ਖਾਸ ਗੱਲ ਇਹ ਹੈ ਕਿ ਇਹ ਫ਼ੋਨ ਬਹੁਤ ਥੋੜ੍ਹੇ ਸਮੇਂ ਦੇ ਵਿੱਚ ਚਾਰਜ ਹੋ ਜਾਂਦਾ ਜਦ ਕਿ ਬਾਕੀ ਕੰਪਨੀਆਂ ਦੇ ਮੋਬਾਈਲ ਨੇ ਉਹਨਾਂ ਨੂੰ ਚਾਰਜ ਹੋਣ ਨੂੰ ਬਹੁਤ ਸਾਰਾ ਸਮਾਂ ਲੱਗਦਾ ਹੈ ਪਰ ਇਹ ਫ਼ੋਨ ਜਿਹੜਾ ਹੈਗਾ ਬਹੁਤ ਘੱਟ ਸਮੇਂ ਦੇ ਵਿੱਚ ਚਾਰਜ ਹੋ ਜਾਂਦਾ ਔਰ ਇਹਦੇ ਵਿੱਚ ਇੱਕ ਹੋਰ ਵਧੀਆ ਕੁਆਲਟੀ ਇਹਦੀ ਜ ਜਿਹੜੀ ਚੀਜ਼ ਲੱਗੀ ਹੈ ਉਹ ਇਹਦੇ ਹੈੱਡਫ਼ੋਨ ਨੇ ਇਹਦੇ ਹੈੱਡਫ਼ੋਨ ਬਹੁਤ ਵਧੀਆ ਕੁਆਲਟੀ ਦੇ ਨੇ ਉਹਦੀ ਸਾਊਂਡ ਬਹੁਤ ਵਧੀਆ ਜਿਹਦੇ ਨਾਲ਼ ਸੁਣ ਕੇ ਮੇਰਾ ਮਨ ਖੁਸ਼ ਹੋ ਗਿਆ ਮੇਰੇ ਦੋਸਤਾਂ ਮਿੱਤਰਾਂ ਨੇ ਵੀ ਤੁਹਾਡੇ ਇਸ ਫ਼ੋਨ ਦੀ ਬੜੀ ਤਰੀਫ਼ ਕੀਤੀ ਹੈ ਔਰ ਉਹਨਾਂ ਨੇ ਵੀ ਮੈਨੂੰ ਪੁੱਛਿਆ ਕਿ ਤੂੰ ਇਹ ਫ਼ੋਨ ਕਿਸ ਦੁਕਾਨ ਤੋਂ ਲਿਆ ਅਤੇ ਇਸ ਤੋਂ ਇਲਾਵਾ ਕੁੱਲ ਓਵਰਆਲ ਦੇਖਿਆ ਜਾਵੇ ਤਾਂ ਇਸ ਫ਼ੋਨ ਦੇ ਵਿੱਚ ਸਾਰੇ ਫ਼ੀਚਰ ਹੈਗੇ ਨੇ ਜਿਹੜੇ ਇੱਕ ਇਨਸਾਨ ਨੂੰ ਚਾਹੀਦੇ ਨੇ ਸੋ ਮੈਂ ਤੁਹਾਡਾ ਜਿਹੜਾ ਹੈਗਾ ਧੰਨਵਾਦ ਕਰਨ ਦੇ ਲਈ ਫ਼ੋਨ ਕਾਲ ਕਰ ਰਿਹਾ ਜੀ ਧੰਨਵਾਦ